ਮੈਂ ਆਪਣੇ ਫ਼ੋਨ ਵਿੱਚ ਵਾਇਸ ਕਾਲ ਵੀ ਵਰਤਦਾ ਹਾਂ ਅਤੇ ਵੀਡੀਓ ਕਾਲ ਵੀ ਜਦੋਂ ਵੀ ਕੋਈ ਛੋਟੀ ਮੋਟੀ ਗੱਲ ਹੁੰਦੀ ਹੈ ਉਦੋਂ ਆਪਣੇ ਅਸੀਂ ਵੋਇਸ ਕਾਲ 'ਤੇ ਜ਼ਿਆਦਾ ਗੱਲ ਕਰਦੇ ਹਾਂ ਅਤੇ ਜਦੋਂ ਘਰ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਜਾਂ ਅਸੀਂ ਥੋੜ੍ਹਾ ਫ੍ਰੀ ਹੁੰਦੇ ਹਾਂ ਤਾਂ ਅਸੀਂ ਉਦੋਂ ਵੀਡੀਓ ਕਾਲ ਨੂੰ ਤਰਜੀਹ ਦਿੰਦੇ ਹਾਂ ਕਿਉਂਕਿ ਵੀਡੀਓ ਕਾਲ 'ਤੇ ਸਾਡੇ ਜਿਹੜੇ ਭੈਣ ਭਰਾ ਵਾ ਦੂਰ ਆ ਅਸੀਂ ਉਹਨਾਂ ਨੂੰ ਦੇਖ ਕੇ ਅਤੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਅਤੇ ਜਦੋਂ ਵੀ ਕਿਤੇ ਸਾਨੂੰ ਆਸੇ ਪਾਸੇ ਇੱਧਰ ਉੱਧਰ ਛੋਟੀ ਗੱਲ ਕਰਨੀ ਹੋਵੇ ਤਾਂ ਅਸੀਂ ਜ਼ਿਆਦਾਤਰ ਵੋਇਸ ਕਾਲ ਯੂਜ ਕਰਦੇ ਹਾਂ ਅਸੀਂ ਫ਼ੋਨ 'ਤੇ ਮੇਅ ਬੀ ਦੋ ਕੁ ਘੰਟੇ ਬਿਤਾ ਲੈਂਦੇ ਹਾਂ ਕੁਛ ਅਸੀਂ ਏ ਬਾਕੀ ਦੇਖਦੇ ਨਿਊਜ਼ ਦੇਖ ਲੈਂਦੇ ਹਾਂ ਅਤੇ ਬ ਅਸੀਂ ਵਾਇਸ ਕਾਲ 'ਤੇ ਜ਼ਿਆਦਾ ਅਸੀਂ ਗੱਲ ਕਰ ਲੈਂਦੇ ਹਾਂ ਹਾਂਜੀ